ਹਾਂ ਮੈਂ ਵੀਡੀਓ ਗੇਮ ਬਾਰੇ ਜਾਣ ਨਾਲ ਇਹ ਗੇਮਾਂ ਬਹੁਤ ਹੀ ਪਸੰਦ ਹਨ ਮੈਨੂੰ ਅਤੇ ਮੈਂ ਇਹ ਵੀਡੀਓ ਗੇਮਾਂ ਖਰੀਦ ਕੇ ਆਪਣੇ ਘਰ ਲਿਆਇਆ ਸੀ ਇਹ ਮੈਂ ਛੋਟੇ ਹੁੰਦੇ ਸੁਪਰ ਮਾਰੀਓ ਡਰੈਗਨ ਫਾਈਟਰ ਕ੍ਰਿਕਟ ਫੁੱਟਬਾਲ ਕਈ ਗੇਮਾਂ ਖੇਲੀਆਂ ਹਨ ਜੋ ਕਿ ਮੈਨੂੰ ਬਹੁਤ ਪਸੰਦ ਸੀ ਔਰ ਇਸ ਨੂੰ ਖੇਡਣ ਨਾਲ਼ ਮੇਰਾ ਥੋੜ੍ਹਾ ਸਮਾਂ ਵੀ ਗੁਜ਼ਰ ਜਾਂਦਾ ਸੀ ਜੋ ਕਿ ਮੈਂ ਬੋਰ ਨਹੀਂ ਹੁੰਦਾ ਸੀ ਬਾਕੀ ਇਸ ਨੂੰ ਖੇਲਣ ਵਿੱਚ ਮੈਂ ਕੋਈ ਜ਼ਿਆਦਾ ਬੰਦਿਆਂ ਦੀ ਲੋੜ ਨਹੀਂ ਹੁੰਦੀ ਇਸਨੂੰ ਇਕੱਲਾ ਵੀ ਹੀ ਖੇਡ ਸਕਦਾ ਸੀ ਜੋ ਕਿ ਮੈਨੂੰ ਬਹੁਤ ਹੀ ਪਸੰਦ ਇਹ ਖੇਡਾਂ ਮੈਨੂੰ ਬਹੁਤ ਹੀ ਪਸੰਦ ਲੱਗਦੀਆਂ ਸੀ